ਹਾਂ ਦਵਾਈਆਂ ਕਿਫਾਇਤੀ ਹੁੰਦੀਆਂ ਹਨ ਜੇਕਰ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਹੁੰਦਾ ਹੈ ਤਾਂ ਮੈਂ ਜ਼ਿਆਦਾਤਰ ਆਪਣੀਆਂ ਦਵਾਈਆਂ ਸਰਕਾਰੀ ਸਿਹਤ ਕੇਂਦਰਾਂ ਤੋਂ ਪ੍ਰਾਪਤ ਕਰਦਾ ਹਾਂ ਜੋ ਕਿ ਬਹੁਤ ਹੀ ਸਸਤੀਆਂ ਹੁੰਦੀਆਂ ਹਨ ਜਿਸ ਨਾਲ਼ ਮੇਰੀ ਆਮਦਨ 'ਤੇ ਬਹੁਤ ਘੱਟ ਅਸਰ ਪੈਂਦਾ ਹੈ